ਕਵਿਤਾ ਗਲਪ ਨਾਟਕ ਦਾ ਮੈਨੂੰ ਬਹੁਤ ਸ਼ੌਂਕ ਹੈਗਾ ਹੈ ਨਾ ਇਹ ਕਵਿਤਾ ਮੈਂ ਕਈ ਵਾਰ ਵਿਹਲੇ ਟਾਈਮ ਦੇ ਵਿੱਚ ਗਾਉਂਦੀ ਵੀ ਰਹਿੰਦੀ ਹਾਂ ਲਿਖ ਵੀ ਲੈਂਦੀ ਹਾਂ ਅਤੇ ਜੋ ਆਪਣੇ ਮਨ ਦੇ ਹਾਵ ਭਾਵ ਹੁੰਦੇ ਨੇ ਕਵਿਤਾ ਕਵਿਤਾ ਗਾ ਕੇ ਆਪਾਂ ਉਹਨਾਂ ਨੂੰ ਜਾਗਰੂਕ ਕਰ ਸਕਦੇ ਹਾਂ ਹੈ ਨਾ ਕਿਸੇ ਦੇ ਕੋਈ ਜਿਵੇਂ ਕੋਈ ਭਰੂਣ ਹੱਤਿਆ ਗਾ ਹੈ ਨਾ ਉਹਦਾ ਆਪਾਂ ਨਾਟਕ ਕਰਕੇ ਵੀ ਆਪਾਂ ਲੋਕਾਂ ਨੂੰ ਸਮਝਾ ਸਕਦੇ ਆਂਗੇ ਅਤੇ ਸਾਨੂੰ ਹਮੇਸ਼ਾ ਕਵਿਤਾ ਲਿਖਣੀ ਵੀ ਚਾਹੀਦੀ ਹੈ ਗਾਉਣੀ ਵੀ ਚਾਹੀਦੀ ਹੈ ਕਵਿਤਾ ਲਿਖਣ ਗਾਉਣ ਦੇ ਨਾਲ ਮਨ ਦਾ ਬਹੁਤ ਸਕੂਨ ਮਿਲਦਾ ਮਨ ਨੂੰ ਅਤੇ ਇਹਨਾਂ ਦਾ ਆਪਸ ਵਿੱਚ ਬਹੁਤ ਤਾਲਮੇਲ ਬਣਿਆ ਰਹਿੰਦਾ ਅਤੇ ਜੋ ਪ੍ਰਭਾਵਸ਼ੈਲੀ ਸ਼ਾਲੀ ਹੈ ਨਾ ਹੈਗਾ ਉਹ ਸਤਿੰਦਰ ਸਰਤਾਜ ਆ ਉਹ ਬਹੁਤ ਵਧੀਆ ਗਾਣੇ ਗਾਉਂਦਾ ਹੈ ਨਾ ਅਤੇ ਸਾਨੂੰ ਆਪਣੇ ਜੋ ਉਹਦੇ ਗਾਣੇ ਸੁਣਦੇ ਹਾਂ ਸਾਨੂੰ ਆਪਣਾ ਪਿਛੋਕੜ ਵੀ ਯਾਦ ਆ ਜਾਂਦਾ ਉਹਦੇ ਗਾਣੇ ਵੀ ਪਰਿਵਾਰ ਕ ਦੇ ਵਿੱਚ ਬੈਠ ਕੇ ਸੁਣੇ ਜਾਂਦੇ ਨੇ ਉਹਦੀਆਂ ਕਵਿਤਾਵਾਂ ਗਾਣੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਅਤੇ ਕਵਿਤਾਵਾਂ ਅਤੇ ਨਾਟਕ ਕਰਕੇ ਆਪਾਂ ਕਿਸੇ ਨੂੰ ਸਮਝਾ ਵੀ ਸਕਦੇ ਹਾਂ ਅਤੇ ਸਾਨੂੰ ਹਮੇਸ਼ਾ ਹੀ ਚੰਗੇ ਗਾਣੇ ਸੁਣਣੇ ਚਾਹੀਦੇ ਆ ਧੰਨਵਾਦ